ਅੱਜ ਕੱਲ੍ਹ ਸਭ ਤੋਂ ਵੱਧ ਵਰਤੀਆਂ ਜਾਣ ਵਾਲੀਆਂ ਐਪਲੀਕੇਸ਼ਨਾਂ ਫੇਸਬੁੱਕ ਵੱਅਟਐਪ ਇੰਸਟਾਗ੍ਰਾਮ ਸਨੈਪਚੈਟ ਐਮਾਜ਼ੋਨ ਟਵੀਟਰ ਆਦਿ ਹਨ ਮੋਬਾਇਲ ਫ਼ੋਨ ਦੇ ਬਹੁਤ ਸਾਰੇ ਫਾਇਦੇ ਹਨ ਇਸ ਦੀ ਮੱਦਦ ਨਾਲ਼ ਅਸੀਂ ਆਪਣੇ ਦੋਸਤਾਂ ਅਤੇ ਮਿੱਤਰਾਂ ਨਾਲ਼ ਅਸਾਨੀ ਨਾਲ਼ ਗੱਲ ਕਰ ਸਕਦੇ ਹਾਂ ਗੇਮਾਂ ਅਤੇ ਐਪਲੀਕੇਸ਼ਨਾਂ ਦੀ ਵਰਤੋਂ ਕਰਕੇ ਅਸੀਂ ਆਪਣਾ ਟਾਈਮ ਨੂੰ ਮਨੋਰੰਜਕ ਬਣਾ ਸਕਦੇ ਹਾਂ ਨਕਸ਼ਿਆਂ ਦੀ ਵਰਤੋਂ ਕਰਕੇ ਅਸੀਂ ਆਪਣਾ ਰਸਤਾ ਲੱਭ ਸਕਦੇ ਹਾਂ ਮਨਰੰਜਨ ਲਈ ਸੰਗੀਤ ਵੀਡਿਓ ਅਤੇ ਹੋਰ ਚੀਜ਼ਾਂ ਦੀ ਅਨੰਦ ਮਾਣ ਸਕਦੇ ਹਾਂ ਈ ਮੇਲ ਅਤੇ ਐਪਾਂ ਰਾਹੀਂ ਕੰਮ ਨੂੰ ਪੂਰਾ ਕਰ ਸਕਦੇ ਹਾਂ ਦੂਜੇ ਪਾਸੇ ਜੇਕਰ ਮੈਂ ਇਸਦੇ ਨੁਕਸਾਨਾਂ ਦੀ ਗੱਲ ਕਰਾਂ ਇਹ ਸਾਨੂੰ ਸਾਡੇ ਜ਼ਰੂਰੀ ਕੰਮ ਤੋਂ ਸਾਡਾ ਧਿਆਨ ਭਟਕਾ ਸਕਦੇ ਹਨ ਇਹਨਾਂ ਦੀ ਜ਼ਿਆਦਾ ਵਰਤੋਂ ਕਰਨ ਨਾਲ਼ ਸਾਡੀਆਂ ਅੱਖਾਂ ਅਤੇ ਗਰਦਨ ਨੂੰ ਨੁਕਸਾਨ ਹੁੰਦਾ ਹੈ ਕੁਝ ਲੋਕ ਇੰਨੇ ਫਾਈ ਇੰਨੇ ਫਸ ਜਾਂਦੇ ਹਨ ਕਿ ਉਹ ਇਹਨਾਂ ਦੀ ਵਰਤੋਂ ਕਾਰਨ ਬੰਦ ਨਹੀਂ ਕਰ ਪਾਉਂਦੇ ਅਤੇ ਉਹਨਾਂ ਦੀ ਨਿੱਜੀ ਜ਼ਿੰਦਗੀ ਵਿੱਚ ਤਣਾਅ ਪੈਂਦਾ ਹੋ ਜਾਂਦਾ ਹੈ ਉਹਨਾਂ ਨੂੰ ਖਰੀਦਣ ਅਤੇ ਵਰਤਣ ਲਈ ਬਹੁਤ ਜ਼ਿਆਦਾ ਪੈਸੇ ਦੇਣੇ ਪੈਂਦੇ ਹਨ ਜੇਕਰ ਉਹ ਸਮਾਰਟ ਫ਼ੋਨ ਦੀ ਮੱਦਦ ਜ਼ਿਆਦਾ ਕਰਦੇ ਹਨ